ਜੀ ਮੈਂ ਅਕਸਰ ਹੀ ਜੋ ਸੈਰ ਸਪਾਟੇ ਦੇ ਲਈ ਇੱਧਰ ਉੱਧਰ ਜਾਂਦਾ ਰਹਿੰਦਾ ਹਾਂ ਕਿਉਂਕਿ ਇਹ ਜ਼ਰੂਰਤ ਹੈ ਮੇਰੀ ਪੜ੍ਹਾਈ ਦੀ ਵੀ ਬਹੁਤ ਜ਼ਰੂਰਤ ਹੈ ਕਿਉਂਕਿ ਸਾਡੇ ਆਰਕੀਟੈਕਚਰ ਦੇ ਵਿੱਚ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਜਿੰਨਾ ਜ਼ਿਆਦਾ ਘੁੰਮੋਂਗੇ ਫਿਰੋਂਗੇ ਉੱਥੋਂ ਦੇ ਜਿਹੜਾ ਨਿੱਜੀ ਉੱਥੋਂ ਦਾ ਮਕਾਨ ਹਨ ਉੱਥੋਂ ਦੀਆਂ ਇਮਾਰਤਾਂ ਹਨ ਉਨ੍ਹਾਂ ਦੇ ਬਾਰੇ ਤੁਸੀਂ ਸਮਝੋਂਗੇ ਉਨ੍ਹਾਂ ਦੀ ਬਣਤਰ ਉਨ੍ਹਾਂ ਦਾ ਬਣਨ ਦਾ ਤਰੀਕਾ ਜਿੰਨਾ ਤੁਸੀਂ ਜਾਣੋਗੇ ਓਨਾ ਹੀ ਜ਼ਿਆਦਾ ਜਿਹੜਾ ਤੁਹਾਡਾ ਤਜਰਬਾ ਵਧੇਗਾ ਅਤੇ ਤੁਸੀਂ ਅੱਗੇ ਉਸਦੀ ਮਦਦ ਦੇ ਨਾਲ ਅੱਗੇ ਵੱਧ ਸਕਦੇ ਹੋ ਅਤੇ ਗੱਲ ਕਰੀ ਜਾਵੇ ਮਨਪਸੰਦ ਸੈਰ ਸਪਾਟੇ ਦੇ ਸਥਾਨ ਦੀ ਤਾਂ ਜਿੱਥੇ ਵੀ ਅੱਜ ਤੱਕ ਗਏ ਹਾਂ ਤਾਂ ਬਹੁਤ ਸਕੂਨ ਮਿਲਦਾ ਹੈ ਬਹੁਤ ਚੰਗਾ ਲੱਗਦਾ ਹੈ ਸੈਰ ਸਪਾਟਾ ਕਰਕੇ ਲੋਕਾਂ ਦੇ ਬਾਰੇ ਜਾਣ ਕੇ ਪਰ ਅੱਜ ਤੱਕ ਜੇ ਸਭ ਤੋਂ ਸੋਹਣਾ ਜਾਂ ਸਭ ਤੋਂ ਅੱਛਾ ਅਗਰ ਲੱਗਿਆ ਹੈ ਤਾਂ ਉਹ ਕਸ਼ਮੀਰ ਦਾ ਜਿਹੜਾ ਸਾਡਾ ਸਫ਼ਰ ਸੀ ਉਹ ਬਹੁਤ ਹੀ ਜ਼ਿਆਦਾ ਅੱਛਾ ਸਫ਼ਰ ਸੀ ਅਤੇ ਕਿਉਂਕਿ ਕਸ਼ਮੀਰ ਨੂੰ ਕਿਹਾ ਹੀ ਜਾਂਦਾ ਹੈ ਵੀ ਉਹ ਧਰਤੀ 'ਤੇ ਜੰਨਤ ਹੈ ਅਤੇ ਉਹ ਵਾਕਿਆ ਹੀ ਜੰਨਤ ਹੀ ਸੀ ਅਸੀਂ ਜਦਕਿ ਗਏ ਵੀ ਅਸੀਂ ਜਦ ਗਏ ਸਾਂ ਉਸ ਵਕਤ ਸ ਗਰਮੀ ਦਾ ਮੌਸਮ ਸੀ ਪਰ ਉੱਥੇ ਜਾ ਕੇ ਸਾਨੂੰ ਸ ਠੰਡ ਪੈ ਗਈ ਉੱਥੇ ਸਾਨੂੰ ਬਰਫ਼ ਦੇਖਣ ਨੂੰ ਨਹੀਂ ਮਿਲੀ ਪਰ ਉੱਥੋਂ ਦੇ ਹਰੀਆਂ ਹਰੀਆਂ ਪਹਾੜੀਆਂ ਦੇਖ ਕੇ ਸਾਡਾ ਮਨ ਹੈ ਜਿਹੜਾ ਉਹ ਬਹੁਤ ਖੁਸ਼ ਹੋ ਗਿਆ ਉੱਥੋਂ ਦੀਆਂ ਐਡੀਆਂ ਉੱਚੀਆਂ ਉੱਚੀਆਂ ਪਹਾੜੀਆਂ 'ਤੇ ਐਨੇ ਸੋਹਣੇ ਸੋਹਣੇ ਉੱਥੋਂ ਦੇ ਜਿਹੜੇ ਦ੍ਰਿਸ਼ ਸਨ ਉਨ੍ਹਾਂ ਨੇ ਸਾਡਾ ਮਨ ਮੋਹ ਲਿਆ ਤਾਂ ਉਹ ਸਭ ਤੋਂ ਜ਼ਿਆਦਾ ਯਾਦਗਾਰ ਸਾਡਾ ਜਿਹੜਾ ਸਫ਼ਰ ਸੀ ਉਹ ਰਹੇਗਾ ਅਤੇ ਉਹ ਹਮੇਸ਼ਾ ਸਾਨੂੰ ਉਸ ਵੱਲ ਦੁਬਾਰਾ ਤੋਂ ਖਿੱਚਦਾ ਹੈ ਸਾਡਾ ਹੋਰ ਮਨ ਕਰਦਾ ਹੈ ਕਿ ਵੀ ਉਸ ਜੰਨਤ ਦੀ ਜਗ੍ਹਾ ਨੂੰ ਦੇਖਣ ਦਾ ਮੌਕਾ ਮਿਲੇ ਅਤੇ ਸਫ਼ਰ ਕਰਨਾ ਹਮੇ ਮਤਲਬ ਇਹੀ ਹੈ ਕਿ ਹਮੇਸ਼ਾ ਕਿਸੇ ਵੀ ਮੌਸਮ ਹੋਵੇ ਕਿਉਂਕਿ ਹੁਣ ਜਿਹੜਾ ਤਾਂ ਉਹ ਸਾਡਾ ਹੈਗਾ ਹੀ ਇਸ ਤਰੀਕੇ ਦੀ ਜਗ੍ਹਾ ਤਾਂ ਮੌਸਮ ਦਾ ਆਪਾਂ ਕੁਛ ਨਹੀਂ ਕਹਿ ਸਕਦੇ ਬਸ ਵਿਹਲੇ ਸਮੇਂ ਵਿੱਚ ਸਫ਼ਰ ਕਰਨਾ ਸਭ ਤੋਂ ਜ਼ਿਆਦਾ ਪਸੰਦ ਹੈ ਕਿ ਸਕੂਨ ਦੇ ਵਿੱਚ ਸਫ਼ਰ ਕਰਿਆ ਜਾਵੇ ਦਿਮਾਗ ਦੇ ਉੱਤੇ ਕੋਈ ਬੋਝ ਨਾ ਹੋਵੇ ਕਿਸੇ ਕੰਮ ਦਾ ਕੰਮ ਨਿਪਟਾ ਕੇ ਸਫ਼ਰ ਕਰਨਾ ਉਹ ਬਹੁਤ ਚੰਗਾ ਲੱਗਦਾ ਹੈ